ਮੈਂ ਆਪਣੇ ਫੋਨ ਦੀ ਵਰਤੋਂ ਕਾਲ ਕਰਨ ਅਤੇ ਕਾਲ ਸੁਣਨ ਵਾਸਤੇ ਹੀ ਕਰਦਾ ਹਾਂ ਅਕਸਰ ਅਤੇ ਕਦੇ ਕਦੇ ਮੈਸੇਜ ਵੀ ਸੁਣ ਲੈਂਦਾ ਅਤੇ ਕੈਮਰਾ 'ਤੇ ਫੋਟੋ ਵਰਤੋਂ ਨਹੀਂ ਮੈਨੂੰ ਆਉਂਦੀ ਕਿਉਂਕਿ ਮੇਰੀ ਉਮਰ ਅੱਸੀ ਤੋਂ ਪਲਸ ਹੈ